ਮੈਂ ਜਦੋਂ ਇੱਕ ਬਾਈਕ ਰਾਈਡ ਕਰਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਇਹ ਦੇਖਦਾ ਹਾਂ ਕਿ ਅਗਰ ਜ਼ਿਆਦਾ ਟਰੈਫਿਕ ਹੈ ਤਾਂ ਮੈਂ ਬਿਲਕੁਲ ਧੀਰੇ ਅਤੇ ਟ੍ਰੈਫਿਕ ਦੇ ਸਾਰੇ ਨਿਯਮਾਂ ਦਾ ਪਾਲਨ ਕਰਕੇ ਚੱਲਦਾ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਰਘਟਨਾ ਨਾ ਬੀਤੇ ਅਤੇ ਬਾਕੀ ਮੈਂ ਮੌਸਮ ਵਜੋਂ ਇਹ ਖਸਤਾ ਸੜਕਾਂ ਜੋ ਵੀ ਤੰਗ ਸੜਕਾਂ ਇਹਨਾਂ ਬਾਰੇ ਸਾਰੀ ਪਹਿਲਾਂ ਜਾਂਚ ਕਰਦਾ ਕਿ ਇਸ ਸੜਕ ਤੋਂ ਜਾਣਾ ਤਾਂ ਇਹ ਕਿਵੇਂ ਹੈ ਅਤੇ ਕਿਹੜਾ ਰਸਤਾ ਸਹੀ ਰਹੂਗਾ ਬਾਕੀ ਗੱਲ ਮੌਸਮ ਦੀ ਮੌਸਮ ਦੇ ਬਾਰੇ ਵੀ ਪੂਰੀ ਜਾਣਕਾਰੀ ਰੱਖਦਾ ਹਾਂ ਅਗਰ ਅਗਰ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦਾ ਮੌਸਮ ਖਰਾਬ ਹੋ ਜਾਂਦਾ ਤਾਂ ਮੈਨੂੰ ਜੋ ਵੀ ਸਹੀ ਲੱਗਦਾ ਹੈ ਜਿੱਥੇ ਰੁਕਣ ਲਈ ਸਹੀ ਜਗ੍ਹਾ ਮੈਂ ਉੱਥੇ ਹੀ ਰੁਕ ਜਾਂਦਾ ਹਾਂ ਅਤੇ ਅਗਰ ਕੋਈ ਜੰਗਲੀ ਜਾਨਵਰ ਸਾਹਮਣੇ ਆ ਜਾਂਦਾ ਹੈ ਤਾਂ ਮੈਂ ਉੱਥੋਂ ਉੱਥੇ ਜਾਣ ਦੀ ਵਜਹਾ ਉਥੋਂ ਨਿਕਲਣ ਦਾ ਕੋਈ ਨਾ ਕੋਈ ਸੌਖਾ ਤਰੀਕਾ ਲੱਭਦਾ ਹਾਂ ਤਾਂ ਕਿ ਉੱਥੋਂ ਆਰਾਮ ਨਾਲ ਨਿਕਲ ਸਕਦਾ ਇਸ ਤਰ੍ਹਾਂ ਮੈਂ ਬਾਈਕ ਰਾਈਡਿੰਗ ਕਰਦੇ ਸਮੇਂ ਨਾ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਚੱਲਦਾ ਹਾਂ ਥੈਂਕ ਯੂ ਸੋ ਮਚ